ਰੂਪਨਗਰ ਜ਼ਿਲ੍ਹੇ ਦੀਆਂ ਸ ਕਈ ਸਾਰੀਆਂ ਸਥਾਨਕ ਕਹਾਣੀਆਂ ਜਾਂ ਕਥਾਵਾਂ ਹਨ ਜਿਵੇਂ ਰੂਪਨਗਰ ਵਿੱਚ ਇੱਕ ਟਿੱਬੀ ਹੈ ਜਿਸਦੇ ਉੱਪਰ ਇੱਕ ਬਹੁਤ ਪੁਰਾਣਾ ਮਹਿਲ ਟਾਈਪ ਬਣਿਆ ਹੋਇਆ ਹੈ ਜਿਸ ਦੇ ਨਾਲ਼ ਇੱਕ ਖੂਹ ਹੈ ਜਿਸ ਵਿੱਚ ਮੰਨਿਆਂ ਜਾਂਦਾ ਹੈ ਬਹੁਤ ਸਾਰਾ ਸੋਨਾ ਲੁਕਿਆ ਹੋਇਆ ਹੈ ਅਤੇ ਜੋ ਉਸਦਾ ਹੱਕਦਾਰ ਹੋਵੇਗਾ ਉਸ ਨੂੰ ਹੀ ਉਹ ਮਿਲੇਗਾ